ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਨਸ਼ਾ ਛੁਡਾਓ ਕੇਂਦਰ ਬਰਨਾਲੇ ਤੋਂ ਬੋਲ ਰਹੇ ਹੋ ਜੀ ਮੈਂ ਮੇਰੇ ਕਜ਼ਨ ਦਾ ਨਸ਼ਾ ਛੁਡਾਓ ਛੁਡਾਉਣਾ ਸੀ ਜੀ ਤੁਸੀਂ ਉਹਦੇ ਬਾਰੇ ਕੁਛ ਦੱਸ ਸਕਦੇ ਹੋ ਉਹ ਤਾਂ ਕੁਛ ਨਹੀਂ ਸੀ ਛੱਡਦਾ ਜੀ ਕਦੇ ਦਾਰੂ ਕਦੇ ਸਿਗਰਟ ਕਦੇ ਕੁਛ ਕਦੇ ਕੁਛ ਬਸ ਇਹੀ ਕੰਮ ਆ ਜੀ ਪੁੱਛੋ ਹੀ ਨਾ ਤੰਗ ਕਰੇ ਪਏ ਐ ਉਹਨਾਂ ਨੇ ਨਹੀਂ ਮੈਮ ਲਿਆਉਣਾ ਤਾਂ ਬਹੁਤ ਔਖਾ ਹੈ ਜੀ ਜੇ ਤੁਸੀਂ ਕੋਈ ਦਵਾਈ ਦੇ ਦਿਉਂਗੇ ਤਾਂ ਬਿਨਾਂ ਦੱਸੇ ਤਾਂ ਅਸੀਂ ਉਹਨੂੰ ਦੇ ਦੇਵਾਂਗੇ ਅੱਛਾ ਜੀ ਤੁਸੀਂ ਕਿੰਨੇ ਕੁ ਵਜੇ ਮਿਲੋਂਗੇ ਜੀ ਠੀਕ ਹੈ ਮੈਮ ਕੋਈ ਨਾ ਟਰਾਈ ਕਰਕੇ ਦੇਖ ਲਾਂਗੇ ਜੀ ਅੱਛਾ ਮੈਮ ਮੈਮ ਫੀਸ ਕਿੰਨੀਂ ਹੈ ਤੁਹਾਡੀ ਠੀਕ ਹੈ ਮੈਮ ਕਿੰਨਾ ਕੁ ਟਾਈਮ ਤੱਕ ਠੀਕ ਹੋ ਜਾਣਗੇ ਜੀ ਉਹ ਠੀਕ ਹੈ ਮੈਮ ਕੋਈ ਨਾ ਮੈਮ ਦੇਖ ਲਾਂਗੇ ਜੀ ਟਾਈਮ ਹਾਂਜੀ ਟਾਈਮ ਲੱਗਿਆ ਤਾਂ ਜ਼ਰੂਰ ਮਿਲਾਂਗੇ ਜੀ ਕੱਲ੍ਹ ਕੋਈ ਨਾ ਮੈਮ ਕੋਈ ਨਹੀਂ ਓਕੇ ਮੈਮ